ਹੈਲੋ ਸਤਿ ਸ਼੍ਰੀ ਅਕਾਲ ਭਾਅ ਜੀ ਅਮਰ ਕੈਬ ਵਾਲੇ ਬੋਲ ਰਹੇ ਹੋ ਭਾਅ ਜੀ ਭਾਅ ਜੀ ਅਸੀਂ ਨਾ ਪਰਸੋਂ ਚੰਡੀਗੜ੍ਹ ਜਾਣਾ ਸੀ ਜਿਸ ਵਾਸਤੇ ਕੈਬ ਬੁੱਕ ਕਰਵਾਈ ਸੀ ਅਤੇ ਕੁਛ ਕਾਰਣਾਂ ਕਰਕੇ ਸਾਡਾ ਪ੍ਰੋਗਰਾਮ ਰੱਦ ਹੋ ਗਿਆ ਜਿਸ ਲਈ ਅਸੀਂ ਨਾ ਆਪ ਜੀ ਨੂੰ ਪੰਜ ਸੌ ਰੁਪਿਆ ਐਡਵਾਂਸ ਪੇਮੈਂਟ ਕੀਤੀ ਸੀ ਅਤੇ ਆਪ ਜੀ ਨੂੰ ਦੱਸਣਾ ਚਾਹੁੰਦੇ ਹਾਂ ਕਿ ਸਾਡਾ ਪ੍ਰੋਗਰਾਮ ਕੈਂਸਲ ਹੋਣ ਕਰਕੇ ਕਿਰਪਾ ਕਰਕੇ ਆਪ ਜੀ ਉਹ ਪੈਸੇ ਸਾਡੇ ਮੋਬਾਇਲ ਨੰਬਰ ਵਾਲੇ ਗੂਗਲ ਪੇ 'ਚ ਟਰਾਂਸਫਰ ਕਰ ਦਿੱਤੇ ਜਾਓ ਅਤੇ ਅੱਗੇ ਤੋਂ ਅਸੀਂ ਤੁਹਾਡੇ ਤੋਂ ਹੀ ਕੈਬ ਕਰਾਵਾਂਗੇ ਕੁਦਰਤੀ ਸਾਡਾ ਪ੍ਰੋਗਰਾਮ ਇਹ ਕੈਂਸਲ ਹੋ ਗਿਆ ਸਾਨੂੰ ਸਾਡੇ ਰਿਸ਼ਤੇਦਾਰਾਂ ਨੇ ਤੁਹਾਡਾ ਨੰਬਰ ਦਿੱਤਾ ਸੀਗਾ ਦੱਸਿਆ ਸੀਗਾ ਵੀ ਤੁਹਾਡਾ ਕੰਮ ਬਹੁਤ ਵਧੀਆ ਇਸ ਲਈ ਆਪ ਜੀ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਸਾਡੇ ਜਿਹੜੇ ਪੈਸੇ ਬਣਦੇ ਆ ਉਹ ਰੀਫੰਡ ਕਰ ਦਿੱਤੇ ਜਾਣ ਅਤੇ ਅੱਗੇ ਤੋਂ ਅਸੀਂ ਇਸ ਗੱਲ ਦਾ ਗੌਰ ਰੱਖਾਂਗੇ